ਵੈਸੇ ਤਾਂ ਆਪਾਂ ਗੱਲ ਕੀਤੀ ਜਾਵੇ ਪਿੰਡਾਂ ਦੇ ਮੂਲ ਖੇਤਰਾਂ ਦੀ ਮੂਲ ਖੇਤਰਾਂ ਦੇ ਵਿੱਚ ਆਪਾਂ ਨੂੰ ਬਹੁਤ ਹੀ ਕਈ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਜ਼ਿਆਦਾਤਰ ਆਪਾਂ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ ਟੋਭੇ ਹੁੰਦੇ ਹੈ ਟੋਭੇ ਜਿਹੜੇ ਹੁੰਦੇ ਹੈ ਟੋਭੇ ਦੇ ਵਿੱਚ ਕਈ ਦਿਨਾਂ ਦਾ ਕਈ ਸਾਲਾਂ ਦਾ ਪਾਣੀ ਖੜ੍ਹਾ ਰਹਿੰਦਾ ਹੈ ਜਿੱਥੋਂ ਬਹੁਤ ਹੀ ਤਰ੍ਹਾਂ ਦੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਹਨ ਅਤੇ ਸਾਨੂੰ ਆਪਣੇ ਖੇਤਾਂ ਦੇ ਵਿੱਚ ਜਾ ਆਪਣੇ ਘਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਪਲਾਸਟਿਕ ਦੀ ਜਾਂ ਟਾਇਰ ਏਸੋ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਰੱਖਣੀ ਚਾਹੀਦੀ ਹੈ ਜਿਵੇਂ ਆਪਾਂ ਟਾਇਰ ਰ ਦੀ ਗੱਲ ਕਰਦੇ ਹਾਂ ਟਾਇਰ ਦੇ ਵਿੱਚ ਪਾਣੀ ਜਮ੍ਹਾਂ ਹੁੰਦਾ ਹੈ ਜਦ ਵੀ ਕੋਈ ਬਾਰਿਸ਼ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਮਤਲਬ ਪਾਣੀ ਜਾਂ ਅਗਰ ਉਹਦੇ ਵਿੱਚ ਜਮ੍ਹਾ ਹੋ ਜਾਂਦਾ ਹੈ ਤਾਂ ਉੱਥੇ ਡੇਂਗੂ ਦੀ ਬਿਮਾਰੀ ਹੋਣ ਦਾ ਬਹੁਤ ਹੀ ਜ਼ਿਆਦਾ ਖ਼ਤਰਾ ਵੱਧ ਜਾਂਦਾ ਹੈ ਆਪਾਂ ਨੂੰ ਇਸ ਚੀਜ਼ ਦਾ ਆਪਾਂ ਨੂੰ ਸਪੈਸ਼ਲ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ